ਹਾਂਜੀ ਬਿਲਕੁਲ ਪੁਰਾਣੀਆਂ ਪੀੜ੍ਹੀਆਂ ਜਿਹੜੀਆਂ ਨਾ ਧਰ ਨਵੀਆਂ ਪੀੜ੍ਹੀਆਂ ਨਾਲ ਜ਼ਿਆਦਾ ਧਾਰਮਿਕ ਸਨ ਪੁਰਾਣੇ ਲੋਕ ਸਿਰਫ ਧਰਮ ਨੂੰ ਹੀ ਸਭ ਕੁਝ ਮੰਨਦੇ ਸਨ ਧਰਮ ਵਿੱਚ ਉਹਨਾਂ ਦਾ ਅਥਾਹ ਵਿਸ਼ਵਾਸ ਹੁੰਦਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਕੋਈ ਸੱਚ ਬੋਲ ਰਹੇ ਹਾਂ ਝੂਠ ਬੋਲ ਰਹੇ ਹਾਂ ਝੂਠ ਬੋਲ ਰਹੇ ਹਾਂ ਪਾਪ ਲੱਗੇਗਾ ਜੇ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ ਪਾਪ ਲੱਗੇਗਾ ਉਹਨਾਂ ਨੂੰ ਹਰ ਚੀਜ਼ ਵਿੱਚ ਆਪਣੇ ਅੰਗ ਸੰਗ ਆਪਣੇ ਆਲੇ ਦੁਆਲੇ ਆਪਣੇ ਚੁਗਿਰਦੇ ਵਿੱਚ ਪਰਮਾਤਮਾ ਪ੍ਰਭੂ ਦਾ ਈਸ਼ਵਰ ਦਾ ਰੂਪ ਨਜ਼ਰ ਆਉਂਦਾ ਸੀ ਉਹ ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ ਉਸ ਬਾਰੇ ਵਿਚਾਰ ਚਰਚਾ ਜ਼ਰੂਰ ਕਰਦੇ ਸਨ ਪਰ ਨਵੀਂ ਪੀੜ੍ਹੀ ਸਾ ਥੋੜ੍ਹਾ ਸਾਇੰਸ ਦਾ ਯੁੱਗ ਆਉਣ ਦੇ ਕਰਕੇ ਨਵੀਂ ਪੀੜ੍ਹੀ ਜਿਹੜੀ ਆ ਸਾ ਸਾਇੰਸ ਵਾਲੀ ਥਿੰਕਿੰਗ ਰੱਖਦੀ ਹੈ ਸਾਇੰਟੀਫਿਕ ਥਿੰਕਿੰਗ ਦੇ ਕਰਕੇ ਉਹ ਲੋਕ ਪਰਮਾਤਮਾ ਨੂੰ ਕੁਝ ਵੀ ਨਹੀਂ ਮੰਨਦੇ ਉਹਨਾਂ ਨੇ ਪਰਮਾ ਕੁਦਰਤ ਨੂੰ ਹੀ ਪਰਮਾਤਮਾ ਦਾ ਰੂਪ ਮੰਨਿਆ ਹੋਇਆ ਏ ਉਹ ਪਰਮਾਤਮਾ ਦੇ ਨਿਰਾਕਾਰ ਨਿਰ ਰੂਪ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਦੋਂ ਕਿ ਪੁਰਾਣੀਆਂ ਪੀੜ੍ਹੀਆਂ ਇਸ ਦੇ ਉਲਟ ਸਨ ਉਸ ਧਰਮ ਨੂੰ ਜ਼ਿਆਦਾ ਮਹੱਤਵਤਾ ਮਹੱਤਵ ਦਿੰਦੇ ਸਨ ਥੈਂਕ ਯੂ